ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਜੀ ਹਾਂਜੀ ਹਾਂਜੀ ਤੁਸੀਂ ਕਿੱਥੇ ਹੈਗੇ ਇਸ ਟਾਇਮ ਦਰਬਾਰ ਸਾਹਿਬ ਲਾਗੇ ਕਿਤੇ ਓਕੇ ਹਾਂਜੀ ਤੁਸੀਂ ਤੁਸੀਂ ਦਰਬਾਰ ਸਾਹਿਬ ਲਾਗੇ ਹੈਗੇ ਹੋ ਦਰਬਾਰ ਸਾਹਿਬ ਤੋਂ ਨਾ ਬਾਈਕ ਕਰਕੇ ਨਾ ਬੁੱਕ ਕਰਨੀ ਪੈਂਦੀ ਆ ਆਟੋ ਕਰ ਲਓ ਜਾਂ ਉਹ ਕਰਨਾ ਪੈਂਦਾ ਉੱਥੋਂ ਕਹੋ ਜੀ ਆਪਾਂ ਬਾਘਾ ਬੋਡਰ ਜਾਣਾ ਠੀਕ ਹੈ ਜੀ ਉੱਥੇ ਤੁਹਾਨੂੰ ਪੰਜ ਵਿੱਚ ਤੁਸੀਂ ਜਾਓਗੇ ਅਤੇ ਤੁਹਾਨੂੰ ਉਹ ਕੀ ਕੀ ਪਹਿਲੇ ਉਹਦੇ ਪਹਿਲੇ ਹੋਏਗਾ ਠੀਕ ਆ ਜੀ ਅਤੇ ਮੁੜ ਕੇ ਮ ਮੁੜ ਕੇ ਹੋਏਗਾ ਮੁੜ ਕੇ ਉਹਨਾਂ ਨੇ ਫਿਰ ਦੇਸ਼ ਭਗਤੀ ਦੇ ਗੀਤ ਗਾਣਗੇ ਠੀਕ ਆ ਜੀ ਮੁੜ ਕੇ ਉੱਧਰ ਪਰੇਡ ਹੋਏਗੀ ਜੀ ਠੀਕ ਆ ਜੀ ਉਸ ਤੋਂ ਬਾਅਦ ਉਹਨਾਂ ਨੇ ਪਰੇਡ ਕਰਨ ਤੋਂ ਬਾਅਦ ਫਿਰ ਸਲਾ ਕਰਕੇ ਸਲਾਮ ਕਰਨਗੇ ਪਰੇਡ ਹੋਏਗੀ ਠੀਕ ਉੱਥੇ ਆਹ ਵੇਖਣ ਯੋਗ ਹੁੰਦੀ ਹੈ

ਠੀਕ ਹੈ ਜੀ ਠੀਕ ਹੈ